ਵਿਕਾਸਸ਼ੀਲ ਸੰਸਾਰ ਬਾਰੇ ਮੇਰੇ ਵਿਚਾਰ ਇਹ ਹਨ ਕਿ ਭਾਰਤ ਵਿੱਚ ਅੱਜ ਕੱਲ੍ਹ ਬਹੁਤ ਵਿਕਾਸ ਹੋ ਚੁੱਕਿਆ ਹੈ ਪਹਿਲਾਂ ਦੇ ਸਮੇਂ ਵਿੱਚ ਜੋ ਤਕਨੀਕਾਂ ਨਹੀਂ ਹੁੰਦੀਆਂ ਸੀ ਅੱਜ ਦੀ ਤਕਨੀਕਾਂ ਨਾਲ ਮਨੁੱਖ ਕੁਛ ਵੀ ਕਰ ਸਕਦਾ ਹੈ ਪੰ ਪ ਜਿਵੇਂ ਕਿ ਹੁਣ ਰੋਬਟ ਸਿਸਟਮ ਹੀ ਆ ਗਿਆ ਹੈ ਇੱਕ ਰੋਬਟ ਜੋ ਸਿਰਫ ਇਨਸਾਨਾਂ ਵਾਂਗ ਪੂਰੀ ਤਰ੍ਹਾਂ ਇਨਸਾਨਾਂ ਵਾਂਗ ਦਿਖਦਾ ਹੈ ਕੋਈ ਦੇਖ ਕੇ ਕਹਿ ਵੀ ਨਹੀਂ ਸਕਦਾ ਕਿ ਉਹ ਕੋਈ ਮਸ਼ੀਨ ਹੈ ਪਰ ਉਹ ਅਸਲ ਵਿੱਚ ਇੱਕ ਰੋਬਟ ਹੈ ਜੋ ਇਨਸਾਨਾਂ ਦੀ ਤਰ੍ਹਾਂ ਦਿਖਦਾ ਤਾਂ ਹੈ ਹੀ ਪਰ ਇਨਸਾਨਾਂ ਦੀ ਤਰ੍ਹਾਂ ਕੰਮ ਵੀ ਕਰ ਸਕਦਾ ਹੈ ਅੱਜ ਕੱਲ੍ਹ ਦੇ ਟਾਈਮ ਵਿੱਚ ਇਨਸਾਨਾਂ ਤੋਂ ਜ਼ਿਆਦਾ ਸਮਝਦਾਰ ਰੋਬੋਟ ਨੂੰ ਮੰਨਿਆ ਜਾਂਦਾ ਹੈ ਇਨਸਾਨ ਮਨੁੱਖ ਮਨੁੱਖਾਂ ਲਈ ਸਭ ਤੋਂ ਜ਼ਿਆਦਾ ਅਸਾਨੀ ਸਮਾਰਟਫੋਨ ਨੇ ਕੀਤੀ ਹੈ ਸਮਾਰਟਫੋਨ ਵਿੱਚ ਕੁਝ ਵੀ ਕਰ ਸਕਦੇ ਹਨ ਐਨੀ ਸਾਰੀ ਸਮਾਰਟਫੋਨ ਵਿੱਚ ਉਪਲਬਧ ਫੈਸਿਲਟੀਸ ਆ ਚੁੱਕੀਆਂ ਹਨ ਜਿਵੇਂ ਕਿ ਜੇ ਕਿਸੇ ਨੂੰ ਫੋਨ ਕਰਨਾ ਹੈ ਅਸੀਂ ਇੱਕ ਕੋਨੇ ਭਾਰਤ ਦੇ ਇੱਕ ਕੋਨੇ ਤੋਂ ਬੈਠਾ ਹੋਇਆ ਵਿਅਕਤੀ ਵੀ ਭਾਰਤ ਦੇ ਦੂਜੇ ਕੋਨੇ ਵਿੱਚ ਬੈਠੇ ਹੋਏ ਵਿਅਕਤੀ ਨੂੰ ਵੀਡੀਓ ਕਾਲ 'ਤੇ ਦੇਖ ਸਕਦਾ ਹੈ ਅਤੇ ਔਨਲਾਈਨ ਪੇਮੈਂਟਜ ਫੋਨ ਦੇ ਵਿੱਚ ਔਨਲਾਈਨ ਪੇਮੈਂਟ ਦਾ ਬਹੁਤ ਜ਼ਿਆਦਾ ਹੀ ਅੱਜ ਕੱਲ੍ਹ ਚੱਲ ਪਿਆ ਹੈ ਜਿਵੇਂ ਕਰੋਨਾ ਤੋਂ ਬਾਅਦ ਸਭ ਤੋਂ ਜ਼ਿਆਦਾ ਕੰਮ ਫੋਨ ਦਾ ਹੀ ਹੋਇਆ ਹੈ ਸਾਰੀ ਜਗ੍ਹਾ ਡਿਜੀਟਲ ਕੈਮਰਾ ਡਿਜੀਟਲ ਇੰਡੀਆ ਸਾਡੇ ਪ੍ਰਧਾਨ ਮੰਤਰੀ ਦੁਆਰਾ ਡਿਜੀਟਲ ਇੰਡੀਆ ਰਾਹੀਂ ਪ ਪੰ ਭਾਰਤ ਵਿੱਚ ਬਹੁਤ ਸਾਰੀ ਵਿਸ ਵਿਕਾਸ ਦੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਹਨ ਗੂਗਲ ਪੇਅ ਜੀਪੇਅ ਫੋਨਪੇਅ ਆਦਿ ਇਹ ਸਾਰੀਆਂ ਚੀਜ਼ਾਂ ਪੇਮੈਂਟ ਦੇ ਵਿੱਚ ਯੂਜ਼ ਹੁੰਦੀਆਂ ਹਨ ਵਕ ਵਿਕਾਸ ਵਿਕਾਸ ਤੋਂ ਇਲਾਵਾ ਸਾਨੂੰ ਦੁਨੀਆ ਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਬਦਲੀ ਹੋਈ ਵੇਖਣ ਨੂੰ ਮਿਲਦੀ ਹੈ ਜਿਵੇਂ ਕਿ ਪਹਿਲਾਂ ਸੌ ਸੌ ਬੰਦਾ ਇੱਕ ਕੰਮ ਨੂੰ ਕਰਨ ਵਿੱਚ ਐਨਾ ਟਾਈਮ ਲਗਾਉਂਦਾ ਸੀ ਹੁਣ ਇੱਕ ਮਸ਼ੀਨ ਹੀ ਉਸ ਸੌ ਉਹਨਾਂ ਸੌ ਬੰਦਿਆਂ ਦਾ ਕੰਮ ਕੁਝ ਕੁ ਦੇਰ ਵਿੱਚ ਕੰਮ ਪੂਰਾ ਕਰਕੇ ਦੇ ਦਿੰਦੀ ਹੈ